ਸਤਿ ਸ਼੍ਰੀ ਅਕਾਲ ਓਕੇ ਮੈਮ ਓਕੇ ਮੈਮ ਕੀ ਔਡਰ ਕਰਨਾ ਚਾਹੋਗੇ ਤੁਸੀਂ ਓਕੇ ਓਕੇ ਠੀਕ ਹੈ ਮੈੋਮ ਓਕੇ ਮੈਮ ਤੁਹਾਡਾ ਔਡਰ ਜਿਹੜੀ ਦਾਲ ਮੱਖਣੀ ਆ ਉਹ ਵਨ ਟਵੈਂਟੀ ਦੀ ਹੈ ਅਤੇ ਪੀ ਪਨੀਰ ਬਟਰ ਮਸਾਲਾ ਜਿਹੜਾ ਆ ਉਹ ਟੂ ਟਵੈਂਟੀ ਦਾ ਹੈ ਹਾਂਜੀ ਅੱਧੇ ਘੰਟੇ 'ਚ ਤੁਹਾਡੇ ਰੂਮ 'ਚ ਭਿਜਵਾ ਦਿੰਦੇ ਹਾਂ ਮੈਮ ਰੂਮ ਸਰਵਿਸ ਆ ਜਾਊ ਠੀਕ ਹੈ ਓਕੇ ਥੈਂਕ ਯੂ